ਸ਼ਾਰਕ ਟੈਂਕ ਨੂੰ ਕੋਣ ਨਹੀਂ ਜਾਣਦਾ ਇਹ ਪਲੈਟਫਾਰਮ ਹੈ ਉਹਨਾਂ ਲੋਕਾਂ ਲਈ ਜਿਨਾਂ ਕੋਲ ਬਿਜਨਸ ਆਈਡੀਆ ਤਾਂ ਹੈ ਪਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕੰਮ ਸ਼ੁਰੂ ਕਰਨ ਲਈ ਸ਼ਾਰਕ ਟੈਂਕ ਕਰਕੇ ਉਹਨਾਂ ਲੋਕਾਂ ਨੂੰ ਫਾਈਨੈਂਸਅਲ ਦੇ ਨਾਲ ਨਾਲ ਮੈਂਟਰ ਵੀ ਮਿਲ ਜਾਂਦੇ ਨੇ ਜਿਹੜੇ ਉਹਨਾਂ ਨੂੰ ਬਿਜ਼ਨਸ ਕਰਨ ਦਾ ਤਰੀਕਾ ਵੀ ਸਿਖਾ ਦਿੰਦੇ ਨੇ ਕਿਉਂਕਿ ਉਹ ਆਪ ਸਫਲ ਬਿਜ਼ਨਸਮੈਨ ਹੁੰਦੇ ਨੇ ਤੇ ਇੱਥੇ ਘਾਟਾ ਖਾਣ ਦੇ ਚਾਂਸਸ ਵੀ ਬਹੁਤ ਘੱਟ ਜਾਂਦੇ ਨੇ ਕਿ ਇੱਕ ਬਹੁਤ ਹੀ ਵਧੀਆ ਪਲੈਟਫਾਰਮ ਬਿਜਨਸ ਮਨਾ ਲਈ